ਹਾਂਜੀ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਆਪਣੇ ਘਰ ਵਿੱਚ ਹੀ ਮੈਂ ਕਿਸੇ ਬਾਹਰ ਜਾ ਕੇ ਨਹੀਂ ਕੰਮ ਕਰਨਾ ਚਾਹੁੰਦੀ ਕਿ ਮੈਂ ਆਪਣੀ ਫੈਮਲੀ ਵਿੱਚ ਹੀ ਆਪਣਾ ਕੋਈ ਵੀ ਕੰਮ ਕਰ ਸਕਾਂ ਬੁਣਾਈ ਦਾ ਤਾਂ ਕਿ ਜੇ ਜਿੱਦਾਂ ਹੁਣ ਛੋਟਾ ਬੱਚਾ ਹੈ ਕਿ ਉਸਦੀ ਕੋਈ ਕੋਟੀ ਜਾਂ ਸਵੈਟਰ ਵਗੈਰਾ ਕੋਈ ਟੋਪ ਵਗੈਰਾ ਬਣਾਉਣਾ ਹੋਏ ਟੋਪੀ ਜੁਰਾਬਾਂ ਹਾਂ ਮੈਂ ਬਣਾਉਂਦੀ ਹਾਂ ਆਪਣੇ ਘਰ ਵਿੱਚ ਹੀ ਬਣਾਉਂਦੀ ਹਾਂ ਅਤੇ ਜ਼ਿਆਦਾ ਉਹ ਉਹਨੂੰ ਬਣਾਉਣ ਵਿੱਚ ਬਹੁਤ ਟਾਈਮ ਲੱਗਦਾ ਹੈ ਜਦ ਵੀ ਕੋਈ ਕਹਿੰਦਾ ਕਿ ਸਾਡੇ ਮਤਲਬ ਇਹ ਬਣਾ ਦੇ ਅਤੇ ਇਹ ਮਨ ਨਹੀਂ ਮੰਨਦਾ ਕਿ ਜਦੋਂ ਅਸੀਂ ਬਣਾਉਂਦੇ ਹਾਂ ਅਤੇ ਬਹੁਤ ਟਾਈਮ ਲੱਗਦਾ ਹੈ ਕਾਫੀ ਨਿਗਾਹ ਵੀ ਲੱਗਦੀ ਹੈ ਤਾਂ ਕਿ ਅਸੀਂ ਕਰ ਸਕੀਏ ਕਿ ਜਿਵੇਂ ਸਾਨੂੰ ਕੋਈ ਕਹਿ ਦਿੰਦਾ ਹੈ ਕਿ ਸਾਡੀ ਕੋਟੀ ਬਣਾ ਦੇ ਅਸੀਂ ਬਣਾਉਂਦੇ ਹੋਈਏ ਅਤੇ ਸਾਨੂੰ ਵੇਖ ਕੇ ਕੋਈ ਕਹਿ ਦੇ ਸਾਡੀ ਵੀ ਬਣਾ ਦੇ ਯਾਨੀ ਕਿ ਨਹੀਂ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਸਾਡੇ ਬੱਚੇ ਖੁਦ ਛੋਟੇ ਬੱਚੇ ਹੁੰਦੇ ਆ ਘਰ ਵਿੱਚ ਅਸੀਂ ਉਹਨਾਂ ਦਾ ਮਤਲਬ ਬੜੀਆਂ ਇੱਛਾਵਾਂ ਨਾਲ ਕਹਿੰਦੇ ਹੈਗੇ ਅਸੀਂ ਇਸ ਦੀ ਆਹ ਚੀਜ਼ ਬਣਾਉਣੀ ਆ ਅਸੀਂ ਮਤਲਬ ਇਹ ਟੋਪ ਬਣਾਉਣਾ ਹੈ ਇਹਦਾ ਇਹ ਬਣਾਉਣਾ ਹੈ ਟੋਪੀ ਬਣਾਉਣੀ ਹੈ ਜੁਰਾਬਾਂ ਬਣਾਉਣੀਆਂ ਹੈ ਅਸੀਂ ਆਪਣੀ ਫੈਮਲੀ ਵਿੱਚ ਬੈਠ ਕੇ ਹੀ ਬਣਾਉਂਦੇ ਹਾਂ ਅਤੇ ਸਾਨੂੰ ਜਦੋਂ ਉਹ ਕੰਮ ਪੂਰੀ ਮਤਲਬ ਬਣਾਉਂਦੇ ਹਾਂ ਅਤੇ ਟਾਈਮ ਨਹੀਂ ਵੀ ਲੱਗੇ ਤਾਂ ਕਹਿੰਦੇ ਹਾਂ ਕਿ ਚਲੋ ਇਹ ਪੂਰੀ ਨਹੀਂ ਹੋਈ ਹਾਲੇ ਜਦੋਂ ਉਹ ਪੂਰੀ ਹੋ ਜਾਂਦੀ ਆ ਤਾਂ ਜਦੋਂ ਅਸੀਂ ਬੱਚੇ ਦੇ ਪਾਉਂਦੇ ਹਾਂ ਅਤੇ ਉਹਨੂੰ ਬਹੁਤ ਸੋਹਣੇ ਲੱਗਦੀ ਹੈ ਫਿਰ ਅਸੀਂ ਸਾਡਾ ਮਨ ਖੁਸ਼ ਹੁੰਦਾ ਹੈ ਕਿ ਅਸੀਂ ਉਹਦੇ ਸਵੈਟਰ ਬਣਾਏ ਸੀ ਬਹੁਤ ਵਧੀਆ ਬਣਿਆ ਫਿਰ ਅਸੀਂ ਕਹਿੰਦੇ ਹਾਂ ਕਿ ਚਲੋ ਕਿਸੇ ਹੋਰ ਦਾ ਵੀ ਅਸੀਂ ਬਣਾਵਾਂਗੇ ਜਦੋਂ ਅਸੀਂ ਆਪਣੇ ਬੱਚੇ ਦੇ ਪਾਉਂਦੇ ਹਾਂ ਅਤੇ ਕਹਿੰਦੇ ਹਾਂ ਕਿ ਨਹੀਂ ਇਸਦਾ ਇਹਦਾ ਹੀ ਆਪਾਂ ਹੋਰ ਕੁਛ ਬਣਾਵਾਂਗੇ ਫਿਰ ਅਸੀਂ ਫਰੀ ਨਹੀਂ ਰਹਿੰਦੇ ਅਸੀਂ ਕਿਸ ਟੋਪੀ ਜਾਂ ਜੁਰਾਬਾਂ ਬਣਾਉਂਦੇ ਹਾਂ ਉਹਦਾ ਪੂਰਾ ਮਤਲਬ ਬਣਾਉਂਦੇ ਆ ਟੋਪ ਵਗੈਰਾ ਬਣਾ ਦਿੰਦੇ ਹਾਂ ਅਸੀਂ ਆਪਣੀ ਫੈਮਲੀ ਵਿੱਚ ਬੈਠ ਕੇ ਹੀ ਬਣਾਉਂਦੇ ਹਾਂ